ਹੈਲੋ ਹਾਂਜੀ ਹਾਂਜੀ ਹਾਂਜੀ ਇਹ ਕਿੱਥੇ ਹੈ ਜੀ ਤੁਹਾਡੀ ਕਿੱਥੇ ਹੈ ਜੀ ਹਾਂਜੀ ਹਾਂਜੀ ਪ੍ਰੋਬਲਮ ਕਿਹੜੀ ਟੁੱਟੀਆਂ 'ਚ ਹੈ ਜੀ ਇਹ ਕਿਹੜੀਆਂ ਜੇ ਇਕੱਠੇ ਜੁਆਇੰਟ ਲਗਾ ਦੇਈਏ ਕੇ ਅਲੱਗ ਅਲੱਗ ਹੈ ਜੀ ਅੱਛਾ ਜੀ ਇਹ ਕਦੋਂ ਤੋਂ ਪ੍ਰੋਬਲਮ ਆਈ ਇਹਨਾਂ 'ਚ ਕਿਹੜੀ ਕੰਪਨੀ ਦੀਆਂ ਜੀ ਟੁੱਟੀਆਂ ਗਰੰਟੀ ਪੀਰੀਅਡ 'ਚ ਹੈਗੀਆਂ ਜਾਂ ਗਰੰਟੀ ਖਤਮ ਹੋ ਚੁੱਕੀ ਆ ਜੀ ਇਨ੍ਹਾਂ ਦੀ ਫਿਰ ਤਾਂ ਇਹ ਤਾਂ ਨਵੀਆਂ ਲਗਾਉਣੀ ਪੈਣੀ ਹੈ ਜੀ ਮੇਰੇ ਕੋਲ ਦੋ ਦਿਨ ਦਾ ਟਾਇਮ ਹੈ ਨਹੀਂ ਤੁਹਾਡੇ ਵਾਸਤੇ ਜੀ ਦੋ ਦਿਨ ਬਾਅਦ ਮੈਂ ਟਾਇਮ ਕੱਢ ਸਕਦਾ ਅੱਜ ਤਾਂ ਹੋ ਨਹੀਂ ਸਕਦੀ ਤੁਸੀਂ ਸਮਾਨ ਲਿਆ ਕੇ ਰੱਖ ਲਿਓ ਮੈਂ ਫੇਰ ਰਾਤ ਨੂੰ ਕੰਮ ਕਰ ਦਉਂ ਤੁਹਾਡਾ ਤੁਸੀਂ ਨੰਬਰ ਦਿਓ ਆਪਣਾ ਜੀ ਠੀਕ ਹੈ ਜੀ ਵੈਸੇ ਘਰ ਤੁਹਾਡਾ ਅਤੇ ਜਿਹੜੀ ਉਹ ਸ਼ਾਬਟ ਵਾਲੀ ਦੁਕਾਨ ਹੈ ਉਹਦੇ ਕੋਲ ਜੀ ਅੱਛਾ ਸੋਮ ਨਾਥ ਜੀ ਚੱਲੋ ਠੀਕ ਹੈ ਜੀ ਫਿਰ ਮੈਂ ਰਾਤ ਨੂੰ ਦੇਖਦਾ ਜੀ ਓਕੇ